ਅਸੀਂ ਜੇ ਗੱਲ ਕਰੀਏ ਤਾਂ ਪੰਜਾਬ 'ਚ ਬਹੁਤ ਸਾਰੀਆਂ ਇਹਦੀਆਂ ਦੀਆਂ ਸਕੀਮਾਂ ਚੱਲਦੀਆਂ ਜਿਹੜੀਆਂ ਸਰਕਾਰੀ ਸਕੀਮਾਂ ਚੱਲਦੀਆਂ ਜਿਹੜੀਆਂ ਲੋਕਾਂ ਨੂੰ ਅ ਉਤਸ਼ਾਹਿਤ ਕਰਦੀਆਂ ਨੇ ਜਿਵੇਂ ਆਪਾਂ ਮਾਤਾ ਕੌਸ਼ਲਿਆ ਕਲਿਆਣ ਸਕੀਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਇਹ ਸਕੀਮ ਜਿਹੜੀ ਹੈ ਦੋ ਹਜ਼ਾਰ ਗਿਆਰਾਂ ਵਿੱਚ ਲਾਗੂ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਅਤੇ ਇਹਦਾ ਬੈਨੀਫਿਟ ਐ ਕਿ ਸਰਕਾਰ ਦੇ ਇਹਦਾ ਇਹ ਬੈਨੀਫਿਟ ਦਿੱਤਾ ਕਿ ਜਿਹੜੀਆਂ ਔਰਤਾਂ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਅ ਡਿਲੀਵਰੀ ਕਰਵਾਉਣਗੀਆਂ ਅਤੇ ਉਹਨਾਂ ਨੂੰ ਜਿਹੜਾ ਨਾ ਉਹ ਬੈਨੀਫਿਟ ਦਿੱਤਾ ਜਾਏਗਾ ਅਤੇ ਉਹਨਾਂ ਨੂੰ ਇੱਕ ਤਾਂ ਇੱਕ ਇੱਕ ਹਜ਼ਾਰ ਰੁਪਇਆ ਕੈਸ਼ ਦਿੱਤਾ ਜਾਏਗਾ ਅਤੇ ਦੂਸਰਾ ਜਿਹੜਾ ਹੈ ਉਹਨਾਂ ਦੇ ਆਪਰੇਸ਼ਨਲ ਐਕਸਪੈਂਸਸ ਯਾਨੀ ਕਿ ਜਿਹੜਾ ਵੀ ਆਪਰੇਸ਼ਨ ਵਗੈਰਾ ਹੈਗਾ ਉਹਨਾਂ ਨੂੰ ਜਿਹੜਾ ਹੈ ਉਹ ਮਤਲਬ ਉਹ ਫਰੀ ਆਫ ਕੋਸਟ ਕੀਤਾ ਜਾਏਗਾ ਅਤੇ ਜੇ ਉੱਥੇ ਕੁੜੀ ਦਾ ਬਰਥ ਹੁੰਦਾ ਤਾਂ ਵੀਹ ਹਜ਼ਾਰ ਰੁਪਈਏ ਤੱਕ ਦਾ ਜਿਹੜਾ ਉਹ ਉਹਨਾਂ ਨੂੰ ਬੈਨੀਫਿਟ ਜਿਹੜਾ ਉਹ ਮਿਲ ਸਕਦਾ ਇ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਪ੍ਰਾਈਜ ਦੇ ਤੌਰ 'ਤੇ ਉਹ ਦਿੱਤਾ ਜਾਂਦਾ ਹੈ ਅਤੇ ਇੱਕ ਆਪਾਂ ਕੰਨਿਆ ਜਾਗ੍ਰਿਤੀ ਜੋਤੀ ਸਕੀਮ ਦੀ ਗੱਲ ਕਰ ਲੈਂਦੇ ਹਾਂ ਉਹਦੇ ਵਿੱਚ ਵੀ ਇਹੀ ਸੀਗਾ ਕਿ ਸਰਕਾਰ ਜਿਹੜੀ ਸੀਗੀ ਉਹ ਪ੍ਰਮੋਟ ਕਰ ਰਹੀ ਸੀਗੀ ਅ ਗਰਲ ਚਾਇਲਡ ਨੂੰ ਕਿ ਵੀ ਹਾਂ ਮਤਲਬ ਕਿ ਗਰਲ ਚਾਇਲਡ ਨੂੰ ਬਚਾਓ ਅਤੇ ਉਹਨਾਂ ਨੂੰ ਜਿਹੜਾ ਉਹ ਬਰਥ ਦਿਓ ਤਾਂ ਕਿ ਜਿਹੜੀ ਔਰਤ ਕਿਉਂਕਿ ਜਿਹੜੀ ਰੇਸ਼ੋ ਹੈਗੀ ਆ ਆਪਾਂ ਦੇਖੀਏ ਮੇਲ ਪਿੱਛੇ ਫੀਮੇਲ ਦੀ ਉਹ ਜਿਹੜੀ ਉਹ ਕਾਫੀ ਘੱਟਦੀ ਪਈ ਆ ਉਹਨੂੰ ਇਕੁਲਾਈਜ ਕਰਨ ਵਾਸਤੇ ਜਿਹੜਾ ਉਹ ਗੌਰਮੈਂਟ ਨੇ ਇਹ ਜਿਹੜੇ ਸਕੀਮਸ ਜਿਹੜੀਆਂ ਉਹ ਕਰਵਾਈਆਂ ਹੈ ਅਤੇ ਇਹਨਾਂ ਦੀ ਇਹਨਾਂ ਨੇ ਕਾਫੀ ਹੱਦ ਤੱਕ ਭਲਾਈ ਕੀਤੀ ਆ ਖ਼ਾਸ ਕਰ ਜਿਹੜੇ ਲੋਅਰ ਸੈਕਸ਼ਨ ਨੇ ਜਿਹੜੇ ਗਰੀਬ ਸੈਕਸ਼ਨ ਇਕੋਨਮੀ 'ਚ ਰਹਿ ਰਹੇ ਨੇ ਉਹਨਾਂ ਨੂੰ ਇਹਨਾਂ ਨਾਲ ਕਾਫੀ ਜਿਹੜੀਆਂ ਉਹ ਫਾਇਦੇ ਮਿਲੇ ਨੇ